ਪੰਜਾਬੀਆਂ ਦੇ ਇਸ ਗਾਇਕੀ ਦੇ ਦੌਰ ਵਿੱਚ ਬਹੁਤ ਹੀ ਸਿੰਗਰ ਬਣ ਰਹੇ ਨੇ ਬਹੁਤ ਹੀ ਮਹਾਨ ਸਿੰਗਰ ਵੀ ਹਨ ਅਤੇ ਬਹੁਤ ਛੋਟੇ ਸਿੰਗਰ ਜੋ ਕਿ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਵੱਧ ਰਹੇ ਨੇ ਮਹਾਨ ਸਿੰਗਰਾਂ ਦੇ ਵਿੱਚੋਂ ਜੋ ਮੈਨੂੰ ਪਸੰਦ ਹਨ ਜਿਵੇਂ ਕਿ ਬੱਬੂ ਮਾਨ ਕਨਵਰ ਗਰੇਵਾਲ ਸਰਤਾਜ ਸਰਤਾਜ ਸੂਫੀ ਗਾਇਕ ਹੈ ਜੋ ਕਿ ਇੱਕ ਪੜ੍ਹਿਆ ਲਿਖਿਆ ਹੋਣ ਕਰਕੇ ਉਸਦੇ ਗੀਤ ਵੀ ਗੰਦਗੀ ਤੋਂ ਬਹੁਤ ਦੂਰ ਨੇ ਜੋ ਸਾਨੂੰ ਪ੍ਰੇਰਨਾ ਦਿੰਦੇ ਨੇ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਲਈ ਉਸਦੇ ਗੀਤ ਇੰਨੇ ਇਕ ਮਨ ਭੋਏ ਗੀਤ ਹਨ ਕਿ ਉਹਨਾਂ ਨੂੰ ਬਾਰ ਬਾਰ ਸੁਣਨ ਵਿੱਚ ਜੀਅ ਕਰਦਾ ਉਹਨਾਂ ਦੀ ਗੀਤਾਂ ਨੂੰ ਸੁਣ ਕਦੇ ਵੀ ਮਨ ਨਹੀਂ ਅੱਕਦਾ ਉਸਦੇ ਗੀਤ ਪਰਿਵਾਰਕ ਗੀਤ ਹਨ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਆ ਅਤੇ ਧੀਆਂ ਭੈਣਾਂ ਲਈ ਸਾਂਝੇ ਗੀਤ ਹਨ